ਤੀਹ ਅਗਸਤ ਦੋ ਹਜ਼ਾਰ ਪੰਜ ਦੋ ਦਸੰਬਰ ਉੱਨੀ ਸੌ ਇਕਾਸੀ ਪੱਚੀ ਜਨਵਰੀ ਦੋ ਹਜ਼ਾਰ ਸਤਾਰਾਂ ਨੌਂ ਜੂਨ ਦੋ ਹਜ਼ਾਰ ਤੇਈ ਸਤਾਰਾਂ ਮਈ ਦੋ ਹਜ਼ਾਰ ਪੰਦਰਾਂ